ਹਾਂਜੀ ਮੈਂ ਆਪਣੇ ਇਲਾਕੇ ਦੇ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਜਾਣਦੀ ਹਾਂ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੇ ਨੇਤਾ ਜੀ ਹਨ ਜਸਵੀਰ ਸਿੰਘ ਡਿੰਪਾ ਕਾਂਗਰਸ ਦੇ ਨੇਤਾ ਹਨ ਅਤੇ ਕਸ਼ਮੀਰ ਸਿੰਘ ਸੂਰ ਆਮ ਆਦਮੀ ਦੇ ਨੇਤਾ ਜੀ ਹਨ ਇਹਨਾਂ ਪਾਰਟੀਆਂ ਦਾ ਏਜੰਡਾ ਇਹ ਸੀ ਕਿ ਅਕਾਲੀ ਦਲ ਚਾਹੁੰਦੇ ਸੀ ਕਿ ਗਰੀਬਾਂ ਨੂੰ ਸਸਤੇ ਤੋਂ ਸਸਤਾ ਰਾਸ਼ਨ ਮਿਲਦਾ ਰਹੇ ਤਾਂ ਜੋ ਗਰੀਬ ਨੂੰ ਰੋਟੀ ਖਾਣੀ ਸੌਖੀ ਹੋ ਜੇ ਅਤੇ ਕਾਂਗਰਸ ਚਾਹੁੰਦੇ ਸੀ ਕਿ ਘਰ ਘਰ ਦੇ ਵਿੱਚ ਰੁਜ਼ਗਾਰ ਦਿੱਤਾ ਜਾਵੇ ਹਰ ਇੱਕ ਨੌਜਵਾਨ ਨੂੰ ਰੁਜ਼ਗਾਰ ਮਿਲ਼ੇ ਰੋਜ਼ੀ ਰੋਟੀ ਦਾ ਸਾਧਨ ਬਣੇ ਆਮ ਆਦਮੀ ਪਾਰਟੀ ਦਾ ਏਜੰਡਾ ਇਹ ਹੈ ਕਿ ਸਿਹਤ ਸੇਵਾਵਾਂ ਗਰੀਬਾਂ ਨੂੰ ਦਿੱਤੀਆਂ ਜਾਣ ਫਰੀ ਵਿਧ ਵਿੱਚ ਅਤੇ ਸਿੱਖਿਆ ਪ੍ਰਣਾਲੀ ਵਿੱਚ ਵੀ ਸੁਧਾਰ ਕੀਤਾ ਜਾਵੇ ਅਤੇ ਗਰੀਬਾਂ ਨੂੰ ਫਰੀ ਸਿੱਖਿਆ ਪਣ ਦਿੱਤੀ ਜਾਵੇ ਅਤੇ ਇਹਨਾਂ ਨਾਗਰਿਕਾਂ ਅਤੇ ਇਹਨਾਂ ਨੇ ਨਾਗਰਿਕ ਦੇ ਤੌਰ 'ਤੇ ਸਾਡੀ ਇਹ ਮਦਦ ਕੀਤੀ ਹੈ ਕਿ ਸਾਡੇ ਸਕੂਲ ਦੇ ਸਿੱਖਿਆ ਸੇਵਾਵਾਂ ਪ੍ਰਣਾਲੀ ਵਿੱਚ ਬਹੁਤ ਹੀ ਤਬਦੀਲੀ ਲਿਆ ਕੇ ਅਤੇ ਸਿਹਤ ਸੇਵਾਵਾਂ ਵਿੱਚ ਵੀ ਬਹੁਤ ਤਬਦੀਲੀ ਲਿਆਂਦੀ ਹੈ